ਵੈਸੇ ਤਾਂ ਮੈਂ ਇੱਕ ਇਹੋ ਜਿਹੇ ਇਲਾਕੇ ਦੀ ਵਸਨੀਕ ਹਾਂ ਜਿੱਥੇ ਕਾਫੀ ਸਾਲ ਕਾਫੀ ਸਾਰੇ ਹਸਪਤਾਲ ਹਨ ਅਤੇ ਕਾਫੀ ਸਾਰੀਆਂ ਜਿਹੜੀਆਂ ਸਿਹਤ ਨੂੰ ਸੁਵਿਧਾਵਾਂ ਜਿਹੜੀਆਂ ਲਾਗੇ ਮਿਲ ਜਾਂਦੀਆਂ ਸਨ ਅਤੇ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਲੱਖ ਖੇਤਰ ਨੂੰ ਜ਼ਿਆਦਾ ਭੀੜ ਅਤੇ ਲੰਮੇ ਸਮੇਂ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਬਾਈ ਚਾਂਸ ਜੇ ਸਾਨੂੰ ਕਿਤੇ ਇਹੋ ਜਿਹੀਆ ਚੁਣੌਤੀ ਦਾ ਨਤੀਜੇ ਸਾਹਮਣੇ ਆ ਜੇ ਅਤੇ ਜਿਹੜੇ ਹੋਸਪੀਟਲ ਦੇ ਸਟਾਫ ਮੈਂਬਰ ਹੁੰਦੇ ਸਨ ਉਹ ਮਰੀਜ਼ ਦੀ ਸਥਿਤੀ ਨੂੰ ਗੰਭੀਰ ਰੱਖਦਿਆਂ ਹੋਇਆ ਜਲਦੀ ਤੋਂ ਜਲਦੀ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਸਨ ਨਹੀਂ ਤਾਂ ਜਿਹੜਾ ਮਰੀਜ਼ ਹੁੰਦਾ ਉਹਦੀ ਸਥਿਤੀ ਕਾਫੀ ਗੰਭੀਰ ਹੋ ਜਾਂਦੀ ਹੈ ਜੇਕਰ ਉਹਦਾ ਛੇਤੀ ਇਲਾਜ ਨਹੀਂ ਹੋਏਗਾ ਅਤੇ ਜੇਕਰ ਕਿਸੇ ਟਾਈਮ ਨਾ ਕਰਕੇ ਕੋਈ ਐਕਸੀਡੈਂਟਲ ਕੇਸ ਆ ਜੇ ਅਤੇ ਉਹਨੂੰ ਉਹਦਾ ਕਾਫੀ ਜ਼ਿਆਦਾ ਜਿਹੜਾ ਉਹਦੇ ਜਿਹੜੀ ਸੱਟ ਲੱਗੀ ਹੁੰਦੀ ਆ ਉੱਥੋਂ ਖੂਨ ਨਿਕਲ ਜਾਂਦਾ ਵਾ ਅਤੇ ਉਹਦਾ ਖੂਨ ਘੱਟ ਜਾਂਦਾ ਵਾ ਖੂਨ ਚੜਾਉਣਾ ਪਏਗਾ ਸਾਨੂੰ ਵੈਸੇ ਤਾਂ ਜਿਹੜੇ ਸਾਡੇ ਹਸਪਤਾਲ ਹੈਗੇ ਆ ਇੱਥੋਂ ਦੇ ਜਿਹੜੇ ਨਰਸਾਂ ਹੈਗੀਆਂ ਵਾ ਉਹ ਸਾਨੂੰ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਕਰਨ ਹੀ ਨਹੀਂ ਦਿੰਦੀਆਂ ਉਹ ਜਿਹੜਾ ਕਿ ਪੇਸ਼ੈਂਟ ਜਾਂਦਾ ਆਪਣਾ ਇਲਾਜ ਕਰਾਉਣ ਉਹ ਪਹਿਲੋਂ ਧਿਆਨ ਦਿੰਦੀਆਂ ਸਨ ਕਿ ਕਿਹਨੂੰ ਜ਼ਿਆਦਾ ਸਾਡੀ ਲੋੜ ਹੈ ਜਾਂ ਕਿਹੜਾ ਇਹੋ ਜਿਹਾ ਸਾਡੇ ਕੋਲ ਮਨ ਮਰੀਜ਼ ਆਇਆ ਜਿਹਨੂੰ ਅਸੀਂ ਪਹਿਲ ਦੇਈਏ ਅਤੇ ਉਹ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨ ਹੀ ਨਹੀਂ ਦਿੰਦੇ ਕਾਫੀ ਅੱਛੀ ਸੁੱਖ ਸੁਵਿਧਾਵਾਂ ਹੈਗੀਆਂ ਸਾਡੇ ਇਲਾਕੇ 'ਚ ਹਸਪਤਾਲਾਂ ਦੇ ਵਿੱਚ